ਹਾਂ ਪਹਿਲਾਂ ਖੇਤਰ ਵਿੱਚ ਪਹਿਲਾਂ ਸਮੇਂ ਵਿੱਚ ਔਰਤਾਂ ਨੂੰ ਭੂਮਿਕਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰੁਕਾਵਟਾਂ ਆਈਆਂ ਸੀ ਉਨ੍ਹਾਂ ਨੂੰ ਕੰਮ ਪੜ੍ਹਾਈ ਕਰਨ ਲਈ ਵੀ ਨਹੀਂ ਪੜ੍ਹਾਈ ਵੀ ਨਹੀਂ ਘੱਟ ਕਰਦੀਆਂ ਸੀ ਅਤੇ ਕੰਮ ਵੀ ਬਹੁਤ ਜ਼ਿਆਦਾ ਕਰਦੀਆਂ ਸੀ ਅਤੇ ਉਨ੍ਹਾਂ ਨੂੰ ਕੋਈ ਪੈਸੇ ਵੀ ਨਹੀਂ ਸੀ ਆਮਦਨ ਵੀ ਨਹੀਂ ਹੁੰਦੀ ਪਰ ਹੁਣ ਪੱਧਰੀ ਖੇਤਰ ਦੀ ਕਾਰਨ ਔਰਤਾਂ ਖੁੱਲ੍ਹ ਕੇ ਆਪਣੀਆਂ ਪੜ੍ਹਾਈਆਂ ਕਰਦੀਆਂ ਹਨ ਅਤੇ ਕੰਮ ਲਈ ਉਹ ਕਿਤੇ ਹੋਰ ਜਾਂਦੀਆਂ ਹਨ ਇਹ ਕਿ ਇਹ ਸਹੀ ਨਹੀਂ ਹੈ ਪਰ ਸਰ ਪਰ ਕਈ ਲੋਕ ਕਈ ਲੋਕ ਆਪਣੇ ਘਰ ਦੇ ਸੰਗ ਘਰ ਦੇ ਬ ਹਾਲਾਤ ਹਾਲਾਤਾਂ ਕਾਰਨ ਬਾਹਰ ਚਲੇ ਜਾਂਦੇ ਹਨ ਅਤੇ ਇਹ ਸੇਫਟੀ ਬਿਲਕੁਲ ਨਹੀਂ ਹੈ ਇਸ ਵਿੱਚ ਬਹੁਤ ਜ਼ਿਆਦਾ ਰੁਕਾਵਟਾਂ ਇਸਤਰੀ ਨੂੰ ਬਹੁਤ ਜ਼ਿਆਦਾ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਇੱਥੇ ਨਵੀਆਂ ਨਵੀਆਂ ਫ ਨਵੀਆਂ ਨਵੀਆਂ ਫੈਕਟਰੀਆਂ ਹੋਰ ਆਊਟਲੈਟਸ ਬਣਾਉਣ ਬਣਾਉਣ 'ਤੇ ਸਰ ਇੱਥੇ ਔਰਤਾਂ ਜਾਂ ਇਸਤ ਔਰਤਾਂ ਜਾਂ ਮਰਦਾਂ ਨੂੰ ਕੰਮ ਮਿਲੇ ਅਤੇ ਲੋਕ ਬਾਹਰ ਵੱਲ ਘੱਟ ਧਿਆਨ ਦੇਣ ਔਰਤਾਂ ਨੂੰ ਬਹੁ ਇਹ ਇਸ ਵਿੱਚ ਬਹੁਤ ਜ਼ਿਆਦਾ ਉਹ ਇਸ ਕਰਕੇ ਜਦੋਂ ਲੋਕ ਜਦੋਂ ਔਰਤਾਂ ਬਾਹਰ ਚਲ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਜਾਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਅੱਜ ਕੱਲ੍ਹ ਦੇ ਥੋੜ੍ਹਾ ਯੁੱਗ ਯੁੱਗ ਬਦਲ ਗਿਆ ਹੈ ਕੁੜੀ ਕੁੜੀ ਇਸਤਰੀਆਂ ਬਹੁਤ ਜ਼ਿਆਦਾ ਪੜ੍ਹ ਲੈ ਪੜ੍ਹ ਲਿਖ ਪੜ੍ਹ ਰਹੀਆਂ ਹਨ ਪਰ ਜ਼ਿਆਦਾਤਰ ਲੋਕ ਬਾਹਰ ਜ਼ਿਆਦਾਤਰ ਇਸਤਰੀਆਂ ਹੀ ਅੱਜ ਕੱਲ੍ਹ ਵੱਡੇ ਪੈਮਾਨੇ ਵੱਡੇ ਪੱਧਰ 'ਤੇ ਆਪਣੀਆਂ ਪੜ੍ਹਾਈਆਂ ਕਰਕੇ ਵਧੀਆ ਚੰਗੀ ਨੌਕਰੀਆਂ 'ਤੇ ਲੱਗੀਆਂ ਹਨ